ਮੇਰੇ ਤਰਨ ਤਾਰਨ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਕਥਾਵਾਂ ਸੱਭਿਆਚਾਰਕ ਮਹੱਤਤਾ ਇਤਿਹਾਸ ਵੈ ਪ੍ਰਚਿਲਤ ਹੈ ਪਰ ਮੈਂ ਆਪਣੇ ਸਿੱਖ ਇਤਿਹਾਸ ਬਾਰੇ ਇਹ ਸਿੱਖ ਹੋਏ ਨੇ ਸਿੱਖ ਧਰਮ ਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਇੱਥੇ ਪਿੰਡ ਠੱਠਾ ਵਿਖੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਉਹਨਾਂ ਨੇ ਇੱਕ ਬੇਔਲਾਦ ਜੋੜਿਆਂ ਲਈ ਜਿਸ ਤਰ੍ਹਾਂ ਪੁੱਤਰ ਦਾ ਵਰ ਦਿੱਤਾ ਸੀ ਮਾਤਾ ਗੰਗਾ ਜੀ ਨੂੰ ਉੱਥੇ ਹੁਣ ਸੰਗਤਾਂ ਪੁੱਤਰ ਦੇ ਵਰ ਲਈ ਦਰਸ਼ਨ ਦੀਦਾਰ ਕਰਨ ਲਈ ਆਉਂਦੀਆਂ ਹਨ ਪਿੰਡ ਨੂਰਦੀ ਵਿਖੇ ਸ਼ਹੀਦ ਸਿੰਘ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਹੋਏ ਨੇ ਜਦੋਂ ਮੁਗਲ ਸਰਕਾਰ ਨੇ ਇਹ ਐਲਾਨ ਕਰਤਾ ਸੀ ਕਿ ਸਿੱਖ ਖਤਮ ਕਰ ਦਿੱਤੇ ਨੇ ਅਤੇ ਉਹਨਾਂ ਨੇ ਇਹ ਗੱਲ ਸੁਣੀ ਉਹਨਾਂ ਕੋਲ ਬਰਦਾਸ਼ਤ ਨਾ ਹੋਈ ਅਤੇ ਉਹਨਾਂ ਨੇ ਰਾਹ ਜਾਂਦੇ ਰਾਹੀਆਂ ਕੋਲੋਂ ਫਿਰ ਟੈਕਸ ਸ਼ੁਰੂ ਕੱਟਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਮੁਗਲ ਸਰਕਾਰ ਨੂੰ ਪਤਾ ਲੱਗਾ ਹਰ ਇੱਕ ਰਾਹੀ ਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਸਿੱਖ ਅਜੇ ਹੈਗੇ ਨੇ ਪਿੰਡ ਨੂਰਦੀ ਵਿਖੇ ਠੱਠੀ ਖਾਰਾ ਵਾ ਪਿੰਡ ਉੱਥੇ ਉੱਥੇ ਝੂਲਣੇ ਮਹਿਲ ਬਾਰੇ ਬਹੁਤ ਸੰਗਤਾਂ ਨੂੰ ਪਤਾ ਹੈ ਕਿ ਉੱਥੇ ਜਦੋਂ ਵੀ ਅਰਦਾਸ ਹੁੰਦੀ ਹੈ ਤਾਂ ਉੱਥੇ ਕੰਧ ਹਿਲਦੀ ਹੈ ਸੋ ਇਹ ਮੇਰੇ ਨਗਰ ਦੀਆਂ ਮੇਰੇ ਜ਼ਿਲ੍ਹੇ ਦੀਆਂ ਕੁਝ ਇਤਿਹਾਸ ਪ੍ਰਚਲਿਤ ਹੈ